ਨਮਸਕਾਰ ਮੇਰਾ ਨਾਮ ਪੂਜਾ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਅੱਜ ਮੈਂ ਆਪਣੇ ਇਲਾਕੇ ਦੇ ਨੇੜੇ ਏ ਵਾਲੇ ਥਾਂ ਲਈ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਇਲਾਕੇ ਵਿੱਚ ਘੁੰਮਣ ਲਈ ਮਿੰਨੀ ਗੋਆ ਜਿੱਥੇ ਬੱਚੇ ਬਹੁਤ ਬੱਚੇ ਅਤੇ ਪਰਿਵਾਰ ਵਾਲੇ ਬਹੁਤ ਹੀ ਪਸੰਦ ਕਰਦੇ ਹਨ ਛੁੱਟੀਆਂ ਵਿੱਚ ਜਾਣਾ ਕਿਉਂਕਿ ਉ ਉਸ ਜਗ੍ਹਾ 'ਤੇ ਜਾਣ ਲਈ ਜਿ ਰਸਤੇ ਵਿੱਚ ਬਹੁਤ ਹੀ ਪਹਾੜੀ ਇਲਾਕੇ ਹਨ ਕਿਉਂਕਿ ਗਰਮੀਆਂ ਵਿੱਚ ਉਧਰ ਜਾਣ ਦਾ ਬਹੁਤ ਹੀ ਅ ਆਨੰਦ ਲੈਂਦੇ ਹਨ ਕਿਉਂਕਿ ਉਸ ਜਗ੍ਹਾ 'ਤੇ ਝੀਲ ਦੀ ਤਰ੍ਹਾਂ ਬਣਿਆ ਅ ਹੋਇਆ ਹੈ ਜਿਸ ਦਾ ਵਿੱਚ ਝੀਲ ਵਿੱਚ ਬੱਚੇ ਜਾਣਾ ਪਾਣੀ ਵਿੱਚ ਅ ਮਸਤੀ ਕਰਨਾ ਬਹੁਤ ਪਸੰਦ ਕਰਦੇ ਹਨ ਉੱਥੇ ਬਹੁਤ ਹੀ ਅਲੱਗ ਅਲੱਗ ਜਗ੍ਹਾ ਬਣੀਆਂ ਹਨ ਜਿੱਥੇ ਕਿ ਬੱਚੇ ਬਹੁਤ ਹੀ ਪਸੰਦ ਕਰਦੇ ਹਨ ਪਹਾੜੀ ਇਲਾਕਾ ਅਤੇ ਠੰਡਾ ਮੌਸਮ ਰਹਿੰਦਾ ਹੈ ਉੱਧਰ ਅਤੇ ਸਾਰੇ ਬੱਚੇ ਉੱਧਰ ਹੀ ਜਾਣਾ ਪਸੰਦ ਕਰਦੇ ਹਨ ਔਰ ਦੂਰੋਂ ਦੂਰੋਂ ਉੱਥੇ ਦੁਨੀਆ ਆਉਂਦੀ ਹੈ ਮਿੰਨੀ ਗੋਆ ਦੇਖਣ ਲਈ ਅਤੇ ਮੈਂ ਆਪਣੇ ਅ ਘਰ ਸਿਲਾਈ ਦਾ ਕੰਮ ਕਰਦੀ ਹਾਂ ਅ ਅਤੇ ਹਾਊਸ ਵਾਈਫ ਹਾਂ